ਸਤਿ ਸ਼੍ਰੀ ਅਕਾਲ ਜੀ ਵਿਕਾਸ ਦੇ ਸੰਦਰਭ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਮੁੱਖ ਚੁਣੌਤੀਆਂ ਦੇ ਮੌਕੇ ਜਿਵੇਂ ਆਰਥਿਕ ਸਮਾਜਿਕ ਵਾਤਾਵਰਨਿਕ ਰਾਜਨੀਤਿਕ ਹਨ ਜਿਨ੍ਹਾਂ ਨੂੰ ਬੁਨਿਆਦੀ ਢਾਂਚੇ ਦੇ ਪੱਖੋਂ ਬਿਹਤਰ ਬਣਾਉਣਾ ਚਾਹੀਦਾ ਹੈ ਜਿਵੇਂ ਹੁਣ ਆਪਾਂ ਆਰਥਿਕ ਚੁਣੌਤੀਆਂ ਦੀ ਗੱਲ ਕਰੀਏ ਜ਼ਿਲ੍ਹੇ ਵਿੱਚ ਰਾਜਨੀਤਿਕ ਰੁਜ਼ਗਾਰ ਦੀ ਸਮਰੱਥਾ ਅਤੇ ਸਮੱਸਿਆਵਾਂ ਹਨ ਜਿਸ ਨਾਲ ਲੋਕਾਂ ਨੂੰ ਮਾਨਵ ਸਾਧਨ ਦੀ ਭਾਵਨਾ ਮਹਿਸੂਸ ਹੁੰਦੀ ਹੈ ਜਿੱਦਾਂ ਸਮਾਜਿਕ ਚੁਣੌਤੀਆਂ ਦੀ ਗੱਲ ਕਰੀਏ ਤਾਂ ਸਿੱਖ ਸਿੱਖ ਸੀ ਦੀ ਗੁਣਵੰਤ ਨੂੰ ਵਡਾਵਾ ਦੇਣ ਲਈ ਸਕੂਲਾਂ ਅਤੇ ਕਾਲਜਾਂ ਵਿੱਚ ਸਾਧਨਾਂ ਦੀ ਮਾਡਵ ਮਨਾਉਣੀ ਲਾਜ਼ਮੀ ਹੈ ਜਿੱਦਾਂ ਹੁਣ ਸਕੂਲਾਂ ਵਿੱਚ ਦੇਖਿਆ ਜਾਵੇ ਤਾਂ ਇਮਤਿਹਾਨ ਦੇ ਟਾਈਮ 'ਤੇ ਬੱਚਿਆਂ ਨੂੰ ਨਕਲ ਮਰਵਾ ਦਿੱਤੀ ਜਾਂਦੀ ਹੈ ਇਹ ਨਹੀਂ ਹੋਣਾ ਚਾਹੀਦਾ ਇਹ ਬੱਚਿਆਂ ਦੇ ਭਵਿੱਖ ਦੇ ਨਾਲ ਖੇਡਿਆ ਜਾ ਰਿਹਾ ਹੈ ਬੱਚੇ ਤਾਂ ਸਮਝਦੇ ਹਨ ਸਾਡਾ ਚੰਗਾ ਹੈ ਪਰ ਇਹ ਚੰਗਾ ਕੰਮ ਨਹੀਂ ਹੈ ਇਹ ਨਹੀਂ ਕਰਨਾ ਚਾਹੀਦਾ ਸਰਕਾਰ ਨੂੰ ਇਸ ਨੂੰ ਸਹੀ ਕਰਨਾ ਚਾਹੀਦਾ ਜਿੱਦਾਂ ਵਾਤਾਵਰਨਕ ਚੁਣੌਤੀਆਂ ਦੇਖੀਆਂ ਜਾਣ ਤਾਂ ਉਸ ਵਿੱਚ ਸਾਨੂੰ ਪਾਣੀ ਜਿਹੜਾ ਸਾਫ਼ ਸੁਥਰਾ ਰੱਖਣਾ ਚਾਹੀਦਾ ਹੈ ਕਹਿ ਰਹੇ ਹਨ ਕਿ ਆਉਣ ਵਾਲੇ ਟਾਈਮ 'ਤੇ ਜਿਹੜਾ ਪਾਣੀ ਆ ਉਸ ਨੂੰ ਬੜੀ ਹੀ ਜ਼ਿਆਦਾ ਕਮੀ ਹੋ ਜਾਵੇਗੀ ਜ਼ਿਲ੍ਹੇ ਨੂੰ ਸੁਰੱਖਿਅਤ ਪਾਣੀ ਦੇਣ ਲਈ ਸਰਕਾਰੀ ਸੰਸਥਾ ਦੀ ਅਗਵਾਈ ਦੀ ਲੋੜ ਹੈ ਜਿਸਦਾ ਸਥਾਨਕ ਸ਼ਾਸਤਰ ਅਤੇ ਯੋਜਨਾਵਾਂ ਵਿਕਾਸ ਲਈ ਵੀ ਪ੍ਰੋਜੈਕਟਾਂ ਨੂੰ ਚੁਣੌਤੀ ਦੇਣ ਲਈ ਠੋਸ ਸ਼ਾਸਤਰ ਅਤੇ ਯੋਜਨਾਵਾਂ ਬਣਾਉਣ ਲਈ ਲਾਗੂ ਕੀਤੇ ਜਾ ਰਹੇ ਹਨ ਕਿਉਂਕਿ ਅਸੀਂ ਅਸੀਂ ਮੁੱਖ ਚੁਣੌਤੀਆਂ ਅਤੇ ਮੌਕੇ 'ਤੇ ਅੰਮ੍ਰਿਤਸਰ ਦੇ ਜਿਲ੍ਹੇ ਦੇ ਵਿਕਾਸ ਅਤੇ ਸੁਧਾਰ ਵਿੱਚ ਕ ਕਾਰਜਗਾਰ ਹੋ ਸਕਦੇ ਹਾਂ ਜਿਨ੍ਹਾਂ ਨਾਲ ਸਮਝੌਤਾ ਅਤੇ ਸਹਿਯੋਗ ਪਰਬੁਕ ਪਰਿਭਾਸਵ ਨਾਲ ਜਿੰਨੇ ਨੂੰ ਇਹ ਮੌਕਾ ਮਿਲ ਸਕਦਾ ਹੈ ਕਿ ਅਗਲੇ ਸਾਲਾਂ ਵਿੱਚ ਸਾਰੇ ਖੇਤਰਾਂ ਵਿੱਚ ਤੇਜ਼ੀ ਨਾਲ ਵਿਕਸਿਤ ਹੋਣ ਧੰਨਵਾਦ ਜੀ